ਹਾਂਜੀ ਮੈਂ ਸਵੇਰੇ ਦੌੜਨ ਲਈ ਜਾਂਦਾ ਹਾਂ ਅੱਧਾ ਘੰਟਾ ਆਪਣੇ ਸਰੀਰ ਲਈ ਕਸਰਤ ਕਰਦਾ ਹਾਂ ਜਿਹੜੀ ਚੀਜ਼ ਦੌੜਨ ਲਈ ਮੈਨੂੰ ਮਜਬੂਰ ਕਰਦੀ ਹੈ ਉਹ ਹੈ ਇੰਸਪੀਰੇਸ਼ਨ ਜਿਹੜੀ ਕਿ ਮੈਨੂੰ ਵੱਖ ਵੱਖ ਤਰ੍ਹਾਂ ਦੇ ਬੋਡੀ ਬਿਲਡਰ ਤੋਂ ਮਿਲਦੀ ਹੈ ਅਤੇ ਮੈਂ ਉਹਨਾਂ ਨੂੰ ਦੇਖ ਕੇ ਆਪਣੇ ਸਰੀਰ ਨੂੰ ਫਿਟ ਕਰਨ ਬਾਰੇ ਸੋਚਦਾ ਰਹਿੰਦਾ ਹਾਂ ਮੇਰੇ ਕਈ ਦੋਸਤ ਹਨ ਜੋ ਜਿੰਮ ਵਿੱਚ ਜਾਂਦੇ ਹਨ ਪਰ ਮੇਰੇ ਕੋਲ ਟੈਮ ਇੰਨਾ ਨਹੀਂ ਹੁੰਦਾ ਕਿਉਂਕਿ ਮੈਂ ਇੱਕ ਕਿਸਾਨ ਹਾਂ ਅਤੇ ਮੈਂ ਖੇਤਾਂ ਵਿੱਚ ਕੰਮ ਕਰਦਾ ਹਾਂ ਤਾਂ ਇਸ ਲਈ ਮੈਂ ਆਪਣੇ ਬਾਡੀ ਨੂੰ ਤੰਦਰੁਸਤ ਕਰਨ ਲਈ ਅੱਧਾ ਘੰਟਾ ਸਵੇਰੇ ਦੌੜਨ ਲਈ ਜਾਂਦਾ ਹਾਂ ਅਤੇ ਮੈਂ ਆਪਣੀ ਬਾਡੀ ਨੂੰ ਫਿੱਟ ਕਰਨ ਦੇ ਲਈ ਬਹੁਤ ਯਤਨ ਕਰਦਾ ਹਾਂ ਰੱਸਾ ਟੱਪਦਾ ਹਾਂ ਅਤੇ ਹੋਰ ਬਹੁਤ ਸਾਰੀਆਂ ਕਸਰਤਾਂ ਕਰਦਾ ਹਾਂ ਯੋਗਾ ਕਰਦਾ ਹਾਂ ਤਾਂ ਇਸ ਨਾਲ ਮੇਰੀ ਜਿਹੜਾ ਸਰੀਰ ਆ ਉਹ ਬਹੁਤ ਫਿੱਟ ਰਹਿੰਦਾ ਹੈ ਅਤੇ ਮੈਂ ਤੰਦਰੁਸਤ ਮਹਿਸੂਸ ਕਰਦਾ ਹਾਂ ਇਹ ਸਾਰੀਆਂ ਗੱਲਾਂ ਦਾ ਜਿਹੜਾ ਧਿਆਨ ਉਹ ਰੱਖਦਾ ਹਾਂ ਅਤੇ ਨਾਲ ਹੀ ਮੈਂ ਖਾਣ ਪੀਣ ਦਾ ਵੀ ਧਿਆਨ ਰੱਖਦਾ ਹਾਂ ਤਲੀਆਂ ਹੋਈਆਂ ਚੀਜ਼ਾਂ ਮੈਂ ਨਹੀਂ ਖਾਂਦਾ ਹਾਂ ਜਿਸ ਨਾਲ ਮੇਰੀ ਬਾਡੀ ਨੂੰ ਕੋਈ ਨੁਕਸਾਨ ਹੋਵੇ ਮੈਂ ਰਨਿੰਗ ਕਰਨ ਵੇਲੇ ਦੋ ਕਿਲੋਮੀਟਰ ਦੀ ਰਨਿੰਗ ਲਗਾਉਂਦਾ ਹਾਂ ਅਤੇ ਯੋਗਾ ਕਰਦਾ ਹਾਂ ਜਿਸ ਨਾਲ ਮੇਰਾ ਸਰੀਰ ਫਿੱਟ ਰਹਿੰਦਾ ਹੈ